ਹਾਂਜੀ ਸਤਿ ਸ਼੍ਰੀ ਅਕਾਲ ਬਾਈ ਭਾਅ ਜੀ ਦੇਖੋ ਜੀ ਆਪਾਂ ਪੰਜਾਬੀ ਹੈਗੇ ਹਾਂ ਪਹਿਲੇ ਤਾਂ ਅਤੇ ਪੰਜਾਬ ਦੇ ਵਿੱਚ ਮਤਲਬ ਪੂਰੀ ਦੁਨੀਆਂ 'ਚ ਅੱਧ ਤੋਂ ਵੱਧ ਚੀਜ਼ਾਂ ਪੰਜਾਬ 'ਚ ਉਗਾਈਆਂ ਜਾਂਦੀਆਂ ਠੀਕ ਹੈ ਜੀ ਜਿੱਦਾਂ ਕਣਕ ਚੌਲ ਸਬਜ਼ੀਆਂ ਦਾਲਾਂ ਫਿਰ ਇਹ ਸਾਰੀਆਂ ਚੀਜ਼ਾਂ ਐਕਸਪੋਰਟ ਕੀਤੀਆਂ ਜਾਂਦੀਆਂ ਹਰ ਇੱਕ ਕੰਟਰੀ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ ਹਰ ਇੱਕ ਕੋਨੇ 'ਚ ਜਿੱਦਾਂ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਆਲੂ ਪਿਆਜ਼ ਹੈਗਾ ਇਹਦਾ ਰੇਟ ਸਭ ਤੋਂ ਲੋ ਹੈਗਾ ਸਿਰਫ ਪੰਜਾਬ ਦੇ ਵਿੱਚ ਇਹ ਆਪਣੀ ਇੰਡੀਆ ਦੇ ਵਿੱਚ ਕਿਉਂਕਿ ਸਭ ਤੋਂ ਜ਼ਿਆਦਾ ਇਹੀ ਦੇਸ਼ ਦੇ ਵਿੱਚ ਉਗਾਈ ਜਾਂਦੀ ਹੈ ਇਹਦੀ ਮਤਲਬ ਡਿਮਾਂਡ ਵੀ ਬਹੁਤ ਜ਼ਿਆਦਾ ਅਤੇ ਇਹਦੀ ਉਗਾਈ ਵੀ ਬਹੁਤ ਜਗ੍ਹਾ ਹੈਗੀ ਜੇ ਇਸ ਕਰਕੇ ਇਹ ਹੀ ਸਬਜ਼ੀਆਂ ਪੰਜਾਬ ਦੇ ਵਿੱਚ ਵੇਚੀਆਂ ਜਾਂਦੀਆਂ ਹਾਂਜੀ ਭਾਅ ਜੀ ਚਲੋ ਠੀਕ ਆ ਭਾਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ